ਹੈਲੋ ਹਾਂਜੀ ਤੁਸੀਂ ਕੌਣ ਬੋਲਦੇ ਹੋ ਜੀ ਹਾਂ ਹਾਂ ਹਾਂ ਹਾਂ ਰੇ ਸਟੇਸ਼ਨ ਮਾਸਟਰ

ਮੁਕਤਸਰ ਦੇ ਨੇੜੇ ਨੇੜੇ ਗੱਡੀਆਂ ਗੱਡੀਆਂ ਬਾਰੇ ਮਤਲਬ ਕਿ ਕਿੱਥੇ ਕਿੱਥੇ ਜਾਂਦੀਆਂ ਗੱਡੀਆਂ ਫਾਜ਼ਿਲਕਾ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਅਤੇ ਫਿਰੋਜਪੁਰ ਅਤੇ ਅਤੇ ਮਤਲਬ ਕਿ ਬਠਿੰਡੇ ਜਿਵੇਂ ਕਿ ਮਤਲਬ ਮੁਕਤਸਰ ਗੁਰਦੁਆਰੇ ਆ ਅਤੇ ਇਤਿਹਾਸਿਕ ਗੁਰਦੁਆਰਾ ਘੁੰਮਣ ਵਾਸਤੇ ਆ ਬਹੁਤ ਸੋਹਣੀ ਜਗ੍ਹਾ ਬਾਜ਼ਾਰ ਦੇ ਵਿੱਚ ਪੈ ਜਾਂਦਾ ਗੁਰਦੁਆਰਾ ਅਤੇ ਬਾਕੀ ਦਾਤਣ ਸਾਹਿਬ ਗੁਰਦੁਆਰਾ ਰਕਾਬ ਸਾਹਿਬ ਆ ਤਰਨ ਤਾਰਨ ਗੁਰਦੁਆਰਾ ਅਤੇ ਟੁੱਟੀ ਗੰਡੀ ਸਾਹਿਬ ਗੁਰਦੁਆਰਾ ਮੇਨ ਬਾਜ਼ਾਰ ਦੇ ਵਿੱਚ ਅਤੇ ਸ਼ਹੀਦਾਂ ਦਾ ਗੁਰਦੁਆਰਾ ਆ ਮੁਕਤਸਰ 'ਚ ਅਤੇ ਬਾਕੀ ਬਠਿੰਡੇ ਮਤਲਬ ਕਿ ਜੇ ਤੁਸੀਂ ਘੁੰਮਣਾ ਹੋਵੇ ਤਾਂ ਬਠਿੰਡੇ ਕਿਲ੍ਹਾ ਆ ਬਹੁਤ ਸੋਹਣਾ ਉਹ ਵੇਖਣਯੋਗ ਹੈ ਹਾਂ ਮਤਲਬ ਕਿ ਇੰਨੀਆਂ ਥਾਵਾਂ 'ਤੇ ਹੈਗਾ ਘੁੰਮਿਆ ਜਾ ਸਕ ਫਿਰੋਜ਼ਪੁਰ ਤਾਂ ਜਿਵੇਂ ਬਾਰਡਰ ਏਰੀਆ ਆ ਬਾਰਡਰ ਵੇਖ ਸਕਦੇ ਆ ਤੁਸੀਂ ਅਤੇ ਫਰੀਦਕੋਟ ਜੇ ਗਏ ਇਹ ਪਾਕਿਸਤਾਨ ਨਾਲ ਲੱਗਦਾ ਬਾਰਡਰ ਜਿਹੜਾ ਪਾਕਿਸਤਾਨ ਦਾ ਅਤੇ ਹਿੰਦੁਸਤਾਨ ਦਾ ਅਤੇ ਫਰੀਦਕੋਟ ਬਾਬਾ ਫਰੀਦ ਦੀ ਜਗ੍ਹਾ ਹੈਗੀ ਆ ਮਤਲਬ ਗੁਰਦੁਆਰਾ ਵੀ ਬਣਿਆ ਹੋਇਆ ਬਾਬੇ ਫਰੀਦ ਦੀ ਜਿੱਥੇ ਬਾਬੇ ਫਰੀਦ ਨੇ ਆਪਣੀ ਉਹ ਗੋਦੜੀ ਲੈ ਕੇ ਬੈਠੇ ਸੀਗੇ ਗੋਦੜੀ ਸਾਹਿਬ ਗੁਰਦੁਆਰਾ ਫਰੀਦਕੋਟ ਹਾਂ ਪਿੰਡ ਤਾਂ ਬਥੇਰੇ ਲੱਗਦੇ ਪਿੰਡ ਤਾਂ ਰਾਹ 'ਚ ਕਈ ਆਉਂਦੇ ਆ ਪਰ ਗੱਡੀਆਂ ਇਹਨਾਂ ਮੇਨ ਮੇਨ ਥਾਵਾਂ 'ਤੇ ਹੀ ਰੁਕਦੀਆਂ ਨੇ ਫਰੀਦਕੋਟ ਕੋਟਕਪੂਰਾ ਅਤੇ ਅਗਾਂਹ ਫਿਰੋਜ਼ ਨਹੀਂ ਅੰਮ੍ਰਿਤਸਰ ਨਹੀਂ ਇਹ ਛੋਟਾ ਸਟੇਸ਼ਨ ਹੈ

ਇਸ ਤੋਂ ਇਲਾਵਾ ਤਾਂ ਨਾ ਲੋਂਗ ਰੂਟ 'ਤੇ ਤਾਂ ਬਸ ਤੜਕੇ ਇੱਕ ਗੱਡੀ ਚਲਦੀ ਆ ਕੋਟਕਪੂਰੇ ਤੋਂ ਬਠਿੰਡਾ ਬਠਿੰਡੇ ਤੋਂ ਫਿਰ ਦਿੱਲੀ ਜਾਂਦੀ ਆ ਉੱਥੋਂ ਡੱਬੇ ਲੱਗ ਜਾਂਦੇ ਨਾਲ ਹਾਂ ਹੋਰ ਤਾਂ ਬਸ ਟਾਈਮਿੰਗ ਤਾਂ ਸਭ ਦੀ ਅੱਡ ਅੱਡ ਹੋਵੇਗੀ ਇੱਕ ਤਾਂ ਕੋਈ ਦੋ ਢਾਈ ਵਜੇ ਜਾਂਦੀ ਗੱਡੀ ਜਿਹੜੀ ਉਹ ਦਿੱਲੀ ਜਾਂਦੀ ਉਹ ਬਠਿੰਡੇ ਜਾ ਕੇ ਬਦਲ ਜਾਂਦੀ ਆ ਬਠਿੰਡਿਓਂ ਫਿਰ ਡੱਬੇ ਨਾਲ ਦਿੱਲੀ ਦੇ ਲੱਗ ਜਾਂਦੇ ਆ ਉਹ ਬਾਰਾਂ ਇੱਕ ਵਜੇ ਤੱਕ ਦਿੱਲੀ ਪਹੁੰਚਾ ਦਿੰਦੀ ਆ